ਮੈਂ ਗੋਨ ਮੈਨ ਮੈਂ ਗਾਉਣ ਦਾ ਬਹੁਤ ਸ਼ੌਂਕ ਗੀਤ ਗਾਉਂਦਾ ਗਾਉਣਾ ਵਿੱਚ ਹਿੱਸਾ ਲਿਆ ਹੈ ਮੈਂ ਉੱਥੇ ਕਈ ਹੋਰ ਕਲਾਕਾਰਾਂ ਨਾਲ ਮਿਲਦਾ ਹਾਂ ਜਿਹਨਾਂ ਤੋਂ ਮੈਂ ਮੈਨ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਜ਼ਿਆਦਾਤਰ ਪੰਜਾਬੀ ਗੀਤ ਹੀ ਗਾਉਂਦਾ ਹਾਂ ਪਰ ਕਈ ਵਾਰ ਹਿੰਦੀ ਵੀ ਮੈਨੂੰ ਹਿੰਦੀ ਗੀਤ ਵੀ ਬਹੁਤ ਪਸੰਦ ਹਨ ਮੈਂ ਆਵਾਜ਼ ਪੰਜਾਬ ਦੀ ਵਿੱਚ ਹੀ ਹਿੱਸਾ ਲਿਆ ਸੀ ਮੈਂ ਮੈਂ ਉੱਥੇ ਕਦੇ ਲੋਕਾਂ ਨਾਲ ਮਿਲਿਆ ਜੋ ਇਸ ਵਿੱਚ ਹਿੱਸਾ ਲੈਣ ਆਏ ਸੀ ਉਹਨਾਂ ਤੋਂ ਵੀ ਮੈਨੂੰ ਕਈ ਕੁਝ ਸਿੱਖਿਆ